ਜਿਹੜਾ ਮਤਲਬ ਜਿਹੜਾ ਮੀਡੀਆ ਹੈਗਾ ਉਹ ਇੱਕ ਇੱਦਾਂ ਦਾ ਪਲੇਟਫਾਰਮ ਹੈ ਚਾਹੇ ਡਿਜ਼ੀਟਲ ਮੀਡੀਆ ਹੋਵੇ ਚਾਹੇ ਪ੍ਰਿੰਟਡ ਮੀਡੀਆ ਹੋਵੇ ਹੈ ਨਾ ਇਹਦੇ ਵਿੱਚ ਬੰਦੇ ਨੂੰ ਮਤਲਬ ਹਰੇਕ ਤਰ੍ਹਾਂ ਦੇ ਬੋਲਣ ਦੀ ਆਜ਼ਾਦੀ ਹੈਗੀ ਆ ਹੈ ਨਾ ਕੋਈ ਬੰਦਾ ਬੋਲਦਾ ਚਾਹੇ ਵੱਡਾ ਛੋਟਾ ਅਮੀਰ ਹੈ ਗਰੀਬ ਹੈ ਨਾ ਹਰੇਕ ਦੀ ਮਤਲਬ ਉਹਦੇ 'ਚ ਬੋਲਣ ਦੀ ਆਜ਼ਾਦੀ ਹੈਗੀ ਹੈ ਪਰ ਇਹਦੇ ਵਿੱਚ ਕੀ ਹੈ ਮਤਲਬ ਕਿਸੇ ਨੂੰ ਗਲਤ ਬਲੇਮ ਕਰਨਾ ਜਾਂ ਕਿਸੇ ਬਾਰੇ ਵੀ ਗਲਤ ਉਹ ਕੁਛ ਕਹਿਣਾ ਹੈ ਨਾ ਕਿਤੇ ਨਾ ਕਿਤੇ ਮਤਲਬ ਇਹ 'ਚ ਬੰਦੇ ਦਾ ਮਾਨਹਾਨੀ ਦਾ ਹੁੰਦਾ ਵੱਡੇ ਬੰਦੇ ਨੂੰ ਡਰ ਵੀ ਰਹਿੰਦਾ ਮੰਨ ਲਓ ਕਿਸੇ ਨੇ ਕਿਸੇ ਪ੍ਰਤੀ ਗਲਤ ਓ ਕਹਿ ਤਾ ਅਤੇ ਬੰਦਾ ਉਹਦੇ 'ਤੇ ਮਾਨਹਾਨੀ ਦਾ ਕੇਸ ਵੀ ਕਰ ਸਕਦਾ ਹੈ ਨਾ ਪਰ ਇਹਦੇ ਵਿੱਚ ਕੀ ਆ ਮਤਲਬ ਜ਼ਿਆਦਾ ਜਿਹੜੀਆਂ ਨਿਊਜ਼ ਅੱਜ ਕੱਲ੍ਹ ਆਉਂਦੀਆਂ ਉਹ ਮਤਲਬ ਮੰਨ ਲਓ ਤੁਸੀਂ ਕਿਸੇ ਬਾਰੇ ਇਨਫੋਰਮੇਸ਼ਨ ਦਿੱਤੀ ਹੈ ਨਾ ਪਰ ਉਹਦੇ 'ਚ ਜਿਹੜੀ ਆ ਤੁਹਾਡੀ ਉਹ ਜਾਣਕਾਰੀ ਗੋਪਨੀਏ ਵੀ ਰੱਖੀ ਜਾਂਦੀ ਹੈ ਹੈ ਨਾ ਮਤਲਬ ਕਿਸੇ ਨੂੰ ਆਪਾਂ ਨੂੰ ਇਹ ਹੁੰਦਾ ਕਿਸੇ ਨੂੰ ਸਾਡੀ ਜਾਣਕਾਰੀ ਜਿਹੜੀ ਸ਼ੇਅਰ ਨਾ ਹੋਵੇ ਹੈ ਨਾ ਅਤੇ ਜ਼ਿਆਦਾ ਮਤਲਬ ਜਾਣਕਾਰੀ ਬੰਦੇ ਦੀ ਗੁਪਨੀਏ ਇਹ ਇਹਦੇ 'ਚ ਰੱਖਦੇ ਆ ਜ਼ਿਆਦਾਤਰ ਚਾਹੇ ਕੋਈ ਪ੍ਰਿੰਟ ਮੀਡੀਆ ਚਾਹੇ ਡਿਜ਼ੀਟਲ ਮੀਡੀਆ ਕੋਈ ਇਹਦੇ ਵਿੱਚ ਕੀ ਹੈ ਮਤਲਬ ਮੀਡੀਆ ਸਾਡੇ ਦੇਸ਼ ਦੀ ਉਹ ਕਰਨ ਤਾਂ ਇੱਕ ਸਭ ਤੋਂ ਵਧੀਆ ਸਾਧਨ ਆ ਮੀਡੀਆ ਪ੍ਰੈਸ ਮੀਡੀਆ ਲਾ ਲਓ ਹੈ ਨਾ ਮਤਲਬ ਸਰ ਜ਼ਿਆਦਾਤਰ ਅੱਜ ਕੱਲ੍ਹ ਸਾਡੇ ਮਤਲਬ ਡਿਜ਼ੀਟਲ ਜਿਹੜਾ ਮੀਡੀਆ ਹੈਗਾ ਪੰਜਾਬ 'ਚ ਬਹੁਤ ਜ਼ਿਆਦਾ ਚੱਲ ਰਿਹਾ ਅਤੇ ਜਿਹ ਦੇ 'ਚ ਕਿਸੇ ਤਰ੍ਹਾਂ ਦੇ ਬੰਦੇ ਕਿਸੇ ਨੂੰ ਕੋਈ ਬੋਲਣ ਦਾ ਡਰ ਨਹੀਂ ਹੁੰਦਾ ਮੰਨ ਲਓ ਉਹਦੇ ਬਾਰੇ ਕਿਸੇ ਬਾਰੇ ਕੀ ਬੋਲ ਕੀ ਨਹੀਂ ਬੋਲ ਰਿਹਾ ਬਟ ਬੰਦੇ ਨੂੰ ਥੋੜ੍ਹਾ ਜਿਹਾ ਬੋਲਣ ਦਾ ਮਤਲਬ ਉਹ ਸਿਸਟਮ ਰੱਖਣਾ ਚਾਹੀਦਾ ਵੀ ਹਾਂ ਉਹਦੇ ਬਾਰੇ ਜੋ ਬੋਲ ਰਿਹਾ ਕੀ ਉਹ ਸਹੀ ਹੈ ਵੀ ਉਹਦੇ ਵਿੱਚ ਅਗਾਂਹ ਜਿਹੜਾ ਕਿਸੇ ਪ੍ਰਕਾਰ ਦੀ ਦਿੱਕਤ ਨਾ ਆਵੇ